ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਬੋਲਦੇ ਆ ਜੀ ਮਨੇਜਰ ਸਾਹਿਬ ਇੱਕ ਬੇਨਤੀ ਸੀਗੀ ਧ ਧਿਆਨ ਨਾਲ ਨਾਲ ਸੁਣਿਉ ਮਾੜਾ ਜਿਹਾ ਵੀ ਅਸੀਂ ਐਤਕੀ ਨਾ ਸੰਗਰਾਂਦ ਦੇ ਉੱਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਲੰਗਰ ਦੀ ਸੇਵਾ ਕਰਨੀ ਚਾਹੁੰਦੇ ਹਾਂ ਅਤੇ ਹਾਂ ਲੰਗਰ ਦੀ ਸੇਵਾ ਕਰਨੀ ਚਾਹੁੰਦੇ ਹਾਂ ਅਤੇ ਇਸ ਕਰਕੇ ਅਸੀਂ ਚ ਚਾਹੁੰਦੇ ਹਾਂ ਵੀ ਅਸੀਂ ਚਾਹ ਅਤੇ ਬ੍ਰੈਡ ਦਾ ਅਸੀਂ ਲੰਗਰ ਲਾਈਏ ਮੈਨੂੰ ਇੱਕ ਤਾਂ ਦੱਸੋ ਜੀ ਉਹਦੇ ਵਾਸਤੇ ਕੀ ਕੀ ਕਰਨਾ ਪਊਗਾ ਤੁਹਾਡੇ ਵੱਲੋਂ ਅਤੇ ਤੁਸੀਂ ਤੁਹਾਡੇ ਸਾਡੇ ਤੁਸੀਂ ਸਾਡੇ ਵੱਲ ਨੂੰ ਕੀ ਕੀ ਸਾਨੂੰ ਇਸ ਗੱਲ ਇਸ ਗੱਲ 'ਤੇ ਸਹਾਇਤਾ ਕਰੋਂਗੇ ਸਾਡੀ ਅਤੇ ਇਹਦੇ ਬਾਰੇ ਦੱਸੋ ਮਾੜਾ ਜਿਹਾ ਅਸੀਂ ਹਜ਼ਾਰ ਪੰਦਰਾਂ ਸੌ ਮ ਪੰਦਰਾਂ ਸੌ ਦਾ ਰੱਖ ਲਉ ਪੰਦਰਾਂ ਸੌ ਸੰਗਤ ਦਾ ਹੈ ਨਾ ਅਰੇਂਜਮੈਂਟ ਦੱਸ ਦਿਉ ਸਾਨੂੰ

ਨਹੀਂ ਤੁਸੀਂ ਐਂ ਕ ਇਸ ਤਰਾਂ ਕਰੋ ਰੱਫ ਸਾਨੂੰ ਐਸਟੀਮੇਟ ਲਾ ਕੇ ਦੇ ਦਿਉ ਅਸੀਂ ਤੁਹਾਨੂੰ ਲਿਆਵਾਂ ਲਿਆ ਕੇ ਦੇ ਦਾਂਗੇ ਬਾਜ਼ਾਰ 'ਚੋਂ ਅਤੇ ਤੁਸੀਂ ਬਸ ਇਹੀ ਬ ਤਿਆਰ ਕਰਨ ਦਾ ਹੀ ਆ ਤਿਆਰ ਦਾ ਸਾਨੂੰ ਦੱਸੋ ਵੀ ਥੋੜ੍ਹਾ ਇਹ ਕਾਰੀਗਰ ਵਗੈਰਾ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਅਤੇ

ਹਾਂਜੀ ਠੀਕ ਹੈ ਜੀ ਅੱਛਾ ਪੰਜ ਸੌ ਪੰ ਪੰਜ ਸੌ ਜਿਹੜੇ ਪੈਕਟ ਹੈਗੇ ਆ ਹਮ ਠੀਕ ਹੈ ਹਾਂਜੀ

ਆਲੂ ਹਾਂਜੀ ਹਾਂਜੀ ਹਾਂਜੀ ਆਲੂ ਤੁਸੀਂ ਵੈਸੇ ਡਾਇਮੰਡ ਵਾਲੇ ਲੈ ਕੇ ਆਈਏ ਕਿ ਚਿਪਸ ਵਾਲੇ ਲੈ ਕੇ ਆਈਏ ਅੱਛਾ ਦੁੱਧ ਹਾਂ ਬਿਲਕੁਲ ਦੁੱਧ ਅਸੀਂ ਵੇਰਕਾ ਦੇ ਪੈਕਟ ਵੇਰਕਾ ਦੇ ਪੈਕਟ ਲਿਆ ਦਾਂਗੇ ਹਾਂਜੀ ਹਾਂਜੀ ਠੀ ਠੀ ਠੀਕ ਹੈ ਮਨੇਜਰ ਸਾਹਿਬ ਅਸੀਂ ਤੁਹਾਨੂੰ ਨਾ ਕਰਦੇ ਆ ਥੋੜ੍ਹੇ ਚਿਰ ਨੂੰ ਫੋਨ ਅਤੇ ਫਿਰ ਤੁਹਾਨੂੰ ਡਿਟੇਲ ਦੱਸਦੇ ਹਾਂ ਐਤਕੀ ਸੰਗਰਾਂਦ 'ਤੇ ਫਿਰ ਅਸੀਂ ਲੰਗਰ ਲਾ ਦਾਂਗੇ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ